ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਅੱਛਾ ਜੀ ਅੱਛਾ ਜੀ ਹਾਂਜੀ ਦੇਖੋ ਭਾਅ ਜੀ ਖਾਣ ਪੀਣ ਦੇ ਮਾਮਲੇ ਮਾ ਕਪੂਰਥਲੇ ਜ਼ਿਲ੍ਹੇ ਵਰਗਾ ਕੋਈ ਜ਼ਿਲ੍ਹਾ ਨਹੀਂ ਜੀ ਹੈਗਾ ਪੰਜਾਬ 'ਚ ਇੱਥੇ ਬਹੁਤ ਵਧੀਆ ਰੈਸਟੋਰੈਂਟ ਤੁਹਾਨੂੰ ਮਿਲ ਜਾਂਦੇ ਆ ਜੀ ਔਰ ਬਹੁਤ ਹੀ ਕਿਫਾਇਤੀ ਰੇਟਾਂ 'ਚ ਮਿਲ ਜਾਂਦੇ ਆ ਜੀ ਹਾਂਜੀ ਇੱਥੇ ਦੀ ਮਸ਼ਹੂਰ ਹਵੇਲੀ ਆ ਜੀ ਹੈਰੀਟੇਜ ਹਵੇਲੀ ਉੱਥੋਂ ਦਾ ਖਾਣਾ ਮੈਂ ਕਹਿੰਦਾ ਪੂਰੇ ਪੰਜਾਬ 'ਚ ਕਿਤੇ ਨਹੀਂ ਮਿਲ ਸਕਦਾ ਜੀ ਇੰਨਾ ਵਧੀਆ ਖਾਣਾ ਹਾਂਜੀ ਉਹਦੀ ਕੋਈ ਰੀਸ ਨਹੀਂ ਖਾਣੇ ਦੀ ਇੰਨਾ ਸਵਾਦ ਇੰਨਾ ਲਾਜਵਾਬ ਖਾਣਾ ਮਿਲਦਾ ਇਹ ਵੀ ਗੱਲ ਛੱਡ ਦਿਉ ਅਸੀਂ ਜਦੋਂ ਵੀ ਪਾਰਟੀ ਕਰਦੇ ਹਾਂ ਅਸੀਂ ਪਹਿਲੀ ਪ੍ਰੈਫਰੈਂਸ ਸਾਡੀ ਹਵੇਲੀ ਨੂੰ ਹੁੰਦੀ ਹੈ ਜੀ ਹਾਂਜੀ ਸਾਰਾ ਸਟਾਫ ਉੱਥੇ ਦਾ ਕੋਪਰੇਟਿਵ ਐਨ ਵਧੀਆ ਢੰਗ ਨਾਲ ਮੈਨੇਜ ਕਰਦਾ ਐਨ ਸਾਫ ਸਫਾਈ ਵਧੀਆ ਹੁੰਦੀ ਹੈ ਜੀ ਵਧੀਆ ਸਰਵਿਸ ਦਿੰਦੇ ਆ ਜੀ ਬਾਕੀ ਰੇਟ ਵੀ ਜੈਨੂਨ ਆ ਜੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਬਾਕੀ ਜੇ ਨਾਨ ਵੈਜ ਖਾਣਾ ਤੁਸੀਂ ਇੱਦਾਂ ਦੇ ਵੀ ਉਰੇ ਬਹੁਤ ਰੈਸਟੋਰੈਂਟ ਹੈਗੇ ਆ ਜੀ ਕੇ ਐਫ ਸੀ ਹੋ ਗਿਆ ਜੀ ਪਹਿਲਾਂ ਤਾਂ ਇੰਟਰਨੈਸ਼ਨਲ ਬ੍ਰੈਂਡ ਆ ਜੀ ਦੇਖੋ ਆਪਣੇ ਉਰੇ ਤਾਂ ਕਪੂਰਥਲੇ ਦਾ ਕੇ ਐਫ ਸੀ ਫੇਮਸ ਆ ਜੀ ਉੱਥੇ ਵਧੀਆ ਸਾਫ ਸਫਾਈ ਵਧੀਆ ਹੁੰਦੀ ਆ ਜੀ ਵਧੀਆ ਢੰਗ ਤਰੀਕੇ ਨਾਲ ਸਰਵਿਸ ਆ ਜੀ ਉਹਨਾਂ ਦੀ ਹਾਂਜੀ ਹੋਰ ਵੀ ਉਰੇ ਕਈ ਤਰ੍ਹਾਂ ਦੇ ਰੈਸਟੋਰੈਂਟ ਆ ਜੀ ਜਿਵੇਂ ਸ਼ਗਨ ਢਾਬਾ ਹੋ ਗਿਆ ਹਾਂਜੀ ਬਾਹਰ ਬਾਹਰ ਆ ਦੇਖੋ ਰੋਡ 'ਤੇ ਟਰੈਫਿਕ ਦਾ ਨਹੀਂ ਸਾਹਮਣਾ ਕਰਨਾ ਪੈਂਦਾ ਹਾਂ ਹਾਂ ਭਾਅ ਜੀ ਸਾਫ ਸਫਾਈ ਮੈਂ ਕਹਿੰਦਾ ਤੁਸੀਂ ਪਲੇਟਾਂ ਐਨੀਆਂ ਚਮਕਦੀਆਂ ਚਾਹੇ ਮੂੰਹ ਦੇਖ ਲਓ ਜੀ ਵਿੱਚ ਨੂੰ ਹਾਂਜੀ ਐਨ ਸਾਫ ਸਫਾਈ ਹੁੰਦੀ ਹੈ ਜੀ ਵਧੀਆ ਨੈਚੁਰਲ ਚੀਜ਼ਾਂ ਤਰੀਕਿਆਂ ਨਾਲ ਵਧੀਆ ਚੀਜ਼ਾਂ ਬਣਾਉਂਦੇ ਇੱਦਾਂ ਨਹੀਂ ਹੈ ਵੀ ਤੁਹਾਨੂੰ ਗੰਦ ਮੰਦ ਖਿਲਾਤਾ ਜਾਂ ਕੋਈ ਤੁਸੀਂ ਬਾਅਦ 'ਚ ਬਿਮਾਰ ਹੋ ਗਏ ਜਾਂ ਕੁਛ ਆ ਹਾਈਜੀਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਉਰੇ ਰੈਸਟੋਰੈਂਟਾਂ 'ਚ ਇਹ ਸ਼ਗਨ ਢਾਬਾ ਤਕਰੀਬਨ ਪੈ ਜਾਂਦਾ ਜੀ ਹੈ ਤਾਂ ਦੇਖੋ ਕੋਸਟਲੀ ਤਾਂ ਥੋੜ੍ਹਾ ਜਿਹਾ ਹੈਗਾ ਬਾਕੀ ਰੈਸਟੋਰੈਂਟਾਂ ਨਾਲੋਂ ਨਾ ਇਹ ਥੋੜ੍ਹਾ ਜਿਹਾ ਕੋਸਟਲੀ ਆ ਪਰ ਤੁਹਾਨੂੰ ਚੀਜ਼ ਇੰਨੀ ਵਧੀਆ ਮਿਲ ਜਾਣੀ ਤੁਹਾਨੂੰ ਪੈਸੇ ਲਾਏ ਪਛਤਾਵਾ ਨਹੀਂ ਹੋਣਾ ਜੀ ਤੁਸੀਂ ਮ ਮਾਣ ਕਰੋਗੇ ਉਰੇ ਪੈਸੇ ਲੱਗੇ ਆ ਬਾਕੀ ਉੱਦਾਂ ਉਰੇ ਸਸਤੇ ਰੈਸਟੋਰੈਂਟ ਵੀ ਹੈਗੇ ਆ ਜੀ ਕਈ ਜਿਵੇਂ ਚਾਯ ਸੂਟਾ ਬਾਰ ਹੋ ਗਿਆ ਵਧੀਆ ਸਨੈਕਰਸ ਮਿਲ ਜਾਂਦੇ ਆ ਉੱਥੇ ਵਧੀਆ ਚਾਹ ਮਿਲ ਜਾਂਦੀ ਹੈ ਜੀ ਕਾਫੀ ਤਰ੍ਹਾਂ ਦੀ ਚਾਹ ਹੁੰਦੀ ਉਹਨਾਂ ਕੋਲ ਫਲੇਵਰਸ ਹੁੰਦੇ ਆ ਸੈਂਡਵਿਚ ਵਗੈਰਾ ਬਰਗਰ ਫੇਮਸ ਆ ਜੀ ਉਹਨਾਂ ਦੇ ਬਰਗਰ ਫੇਮਸ ਆ ਤਾਂ ਖਾਸ ਤੌਰ 'ਤੇ ਹੋਰ ਨਿਊਯਰਕ ਕੈਫੇਟੇਰੀਆ ਹੈਗਾ ਹੈ ਇਹਨਾਂ ਦੇ ਕੰਬੋਜ ਫੇਮਸ ਆ ਜੀ ਕੰਬੋ ਕਈ ਤਰ੍ਹਾਂ ਦੇ ਇਹਨਾਂ ਨੇ ਤਿਆਰ ਕਰੇ ਹੋਏ ਆ ਵਿੱਚ ਮਤਲਬ ਬੇਵਰੇਜੀਜ ਹੁੰਦੇ ਆ ਵਿੱਚ ਫਰਾਈਜ ਹੁੰਦੇ ਆ ਵਿੱਚ ਬਰਗਰ ਪੀਜ਼ਾ ਕੁਛ ਐਵੇਂ ਦੀ ਮੀਲ ਇੱਕ ਪੂਰੀ ਤਿਆਰ ਕਰ ਦਿੰਦੇ ਆ ਘੱਟ ਪੈਸਿਆਂ 'ਚ ਹਾਂਜੀ ਇੱਕ ਬੰਦਾ ਆਰਾਮ ਨਾਲ ਰੱਜ ਜਾਂਦਾ ਉਹ ਮੀਲ ਨਾਲ ਹਾਂਜੀ ਬਹੁਤ ਵਧੀਆ ਵਧੀਆ ਰੈਸਟੋਰੈਂਟ ਆ ਜੀ ਉਰੇ ਕਪੂਰਥਲੇ ਤੁਸੀਂ ਬੇਫਿਕਰ ਹੋ ਕੇ ਆਓ ਤਾਂ ਸਹੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ